ਅਸੀਂ ਆਪਣੀ ਸਾਈਕਲ ਦੀ ਦੇਖਭਾਲ ਬੜੇ ਦੀ ਬੜੇ ਵਧੀਆ ਤਰੀਕੇ ਨਾਲ ਕਰਦੇ ਹਾਂ ਅਸੀਂ ਜਦੋਂ ਗੰਦੀ ਹੁੰਦੀ ਹੈ ਅਸੀਂ ਪਹਿਲਾਂ ਉਹਨੂੰ ਸਾਫ ਸਫਾਈ ਨਾਲ ਪ੍ਰੋਪਰ ਉਹਦੇ ਪਾਣੀ ਨਾਲ ਉਹਨੂੰ ਧੋਣਾ ਉਹਦੀ ਚੇਨ ਨੂੰ ਤੇਲ ਲਾਉਣਾ ਉਹਦੇ ਪੇਂਟ ਨੂੰ ਖਰਾਬ ਨਾ ਹੋਵੇ ਇਸ ਲਈ ਕੁਛ ਪਾਣੀ ਪੂਣੀ ਲਾਉਣਾ ਉਹਨੂੰ ਟਾਈਮ ਸਿਰ ਜਦੋਂ ਗੰਦੀ ਹੋਵੇ ਉਹਨੂੰ ਨਾਲ ਕੱਪੜਾ ਮਾਰਦੇ ਜਾਣਾ ਉਹਦੇ ਟਾਇਰਾਂ ਦੀ ਦੇਖਭਾਲ ਕਰਨੀ ਟਾਇਰ ਟਾਈਮ ਟੂ ਟਾਈਮ ਬਦਲਾਉਣੇ ਟਾਇਰਾਂ 'ਚ ਅਸੀਂ ਟਿਊਬ ਪਾਉਣੀ ਹਵਾ ਪਰੋਪਰ ਉਹਦੀ ਮੈਨਟੇਨਸ ਰੱਖਣੀ ਆ ਅਤੇ ਸਾਨੂੰ ਅਤੇ ਕਈ ਵਾਰੀ ਸਾਈਕਲ ਚਲਾਉਣਾ ਇੱਕ ਬੜੀ ਥਕਾਵਟ ਵਾਲੀ ਚੀਜ਼ ਵੀ ਹੋ ਜਾਂਦੀ ਆ ਕਿਉਂਕਿ ਸਾਨੂੰ ਜ਼ਿਆਦਾਤਰ ਆਦਤ ਨਹੀਂ ਹੁੰਦੀ ਕਿ ਨਾ ਸਾਈਕਲ ਚਲਾਉਣੀ ਸਾਈਕਲ ਇੱਕ ਥਕਾਵਟ ਵਾਲੀ ਚੀਜ਼ ਹੋ ਜਾਂਦੀ ਆ ਕਈ ਵਾਰੀ ਤਾਂ ਜਦੋਂ ਜ਼ਿਆਦਾ ਲੰਬੇ ਰੂਟ 'ਤੇ ਜਾਣਾ ਅਤੇ ਉਦੋਂ ਅਸੀਂ ਇੱਦਾਂ ਥਕਾਵਟ ਨੂੰ ਇੱਦਾਂ ਕਰ ਸਕਦੇ ਜਿਵੇਂ ਥੋੜ੍ਹਾ ਪਾਣੀ ਪੀ ਲਿਆ ਗਲੂਕੋਸ ਵਗੈਰਾ ਥੋੜ੍ਹਾ ਨਾਲ ਖਾਣ ਪੀਣ ਦਾ ਥੋੜ੍ਹਾ ਰੈਸਟ ਲੈ ਕੇ ਉਹਦੇ ਨਾਲ ਅਸੀਂ ਸਭ ਕੁਛ ਵਧੀਆ ਸਾਡਾ ਹੋ ਜਾਂਦਾ ਵਾ ਅਸੀਂ ਸਾਈਕਲਿੰਗ ਕਰਨੀ ਇੱਕ ਬੜੀ ਵਧੀਆ ਚੀਜ਼ ਆ ਸਾਡੀ ਸਿਹਤ ਉਹਦੇ ਨਾਲ ਬਣੀ ਰਹਿੰਦੀ ਆ ਥੈਂਕ ਯੂ